ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਨੀਰੂ ਹੈ ਔਰ ਮੈਂ ਗੁਰਦਾਸਪੁਰ ਦੇ ਰਹਿਣ ਵਾਲੀ ਹਾਂ ਔਰ ਮੈਂ ਆਪਣੀ ਮੈਨੂੰ ਬਹੁਤ ਹੀ ਵਧੀਆ ਆਪਣੇ ਜਿਹੜੇ ਆਪਣੇ ਕਵੀ ਹਨ ਜਿਹੜੇ ਆਪਣੇ ਸ਼ਿਵ ਕੁਮਾਰ ਬਟਾਲਵੀ ਦੇ ਬਾਰੇ ਮੈਂ ਦੱਸਣਾ ਚਾਹੁੰਦੀ ਹਾਂ ਸ਼ਿਵ ਕੁਮਾਰ ਬਟਾਲਵੀ ਉਹ ਮਤਲਬ ਬਹੁਤ ਹੀ ਵਧੀਆ ਕਵੀ ਸੀ ਔਰ ਉਹ ਬ੍ਰਾਹਮਣ ਪਰਿਵਾਰ ਦੇ ਵਿੱਚੋਂ ਸੀ ਘਰਾਣੇ ਦੇ ਰ ਰਹਿਣ ਵਾਲੇ ਘਰਾਣੇ ਦੇ ਸੀ ਉਹ ਉਹ ਪਾਕਿਸਤਾਨ ਵਿੱਚ ਉਹਨਾਂ ਦਾ ਜਨਮ ਪਾਕਿਸਤਾਨ ਵਿੱਚ ਹੋਇਆ ਉਹਨਾਂ ਦੇ ਪਿਤਾ ਪੰਡਿਤ ਕ੍ਰਿਸ਼ਨ ਗੋਪਾਲ ਪਿੰਡ ਦੇ ਤਹਿਸੀਲਦਾਰ ਸਨ ਅਤੇ ਮਾਤਾ ਸ਼੍ਰੀ ਸ਼ਾਂਤੀ ਦੇਵੀ ਜੀ ਘਰੇਲੂ ਔਰਤ ਸਨ ਵੰਡ ਤੋਂ ਬਾਅਦ ਉਹ ਬਟਾਲੇ ਜ਼ਿਲ੍ਹਾ ਗੁਰਦਾਸਪੁਰ ਆ ਗਏ ਉੱਥੇ ਵੀ ਹੀ ਸ਼ਿਵ ਨੇ ਆਪਣੀ ਮੁੱਢਲੀ ਸਿੱਖਿਆ ਪ੍ਰਾਪਤ ਕੀਤੀ ਉਹ ਰੋਮਾਟਿਕ ਕਵੀ ਸਨ ਉਹਨਾਂ ਦੀ ਸੁਰੀਲੀ ਆਵਾਜ਼ ਨੇ ਉਹਨਾਂ ਨੂੰ ਅਤੇ ਉਹਨਾਂ ਦੀ ਕਵਿਤਾ ਨੂੰ ਬਹੁਤ ਹੀ ਹਰਮਨ ਪਿਆ ਹਰਮਨ ਤਿਆਰ ਬਣਾ ਦਿੱਤਾ ਉਹਨਾਂ ਨੂੰ ਕਵੀ ਕਾਵਿ ਨਾਟਕ ਲੂਣਾ 'ਤੇ ਸਾਹਿਤ ਅਕਾਦਮੀ ਇਨਾਮ ਮਿਲਿਆ ਉਹਨਾਂ ਦੀਆਂ ਕਾਫ਼ੀ ਰਚਨਾਵਾਂ ਹਨ ਪੀੜਾਂ ਦਾ ਪਰਾਗਾ ਲਾਜਬੰਤੀ ਆਟੇ ਦੀਆਂ ਆਟੇ ਦੀਆਂ ਚਿੜੀਆਂ ਮੈਨੂੰ ਵਿਦਾ ਕਰੋ ਉਹਨਾਂ ਦੀਆਂ ਰਚਨਾਵਾਂ ਉਹ ਬਹੁਤ ਹੀ ਵਧੀਆ ਅਤੇ ਬਹੁਤ ਹੀ ਵਧੀਆ ਕਵੀ ਸਨ ਉਹਨਾਂ ਨੇ ਬਹੁਤ ਹੀ ਵਧੀਆ ਮਤਲਬ ਕਿ ਬਹੁਤ ਹੀ ਪਿਆਰ ਉਹਨਾਂ ਨੇ ਦੁਨੀਆਂ ਤੋਂ ਲਿੱਤਾ ਔਰ ਬਹੁਤ ਹੀ ਵਧੀਆ ਇੱਕ ਅੱਛੇ ਕਲਾਕਾਰ ਔਰ ਅੱਛੇ ਕਵੀ ਸਨ ਥੈਂਕ ਯੂ